ਪੰਜਾਬ ਦੇ ਲੋਕਾਂ ਦੀ ਪਹਿਚਾਣ ਬਣਾਉਣ ਵਿੱਚ ਇਤਿਹਾਸ ਦੀ ਬਹੁਤ ਵੱਡੀ ਭੂਮਿਕਾ ਹੈ ਇਤਿਹਾਸ ਹਮੇਸ਼ਾ ਹੀ ਲੋਕਾਂ ਦਾ ਗਵਾਹ ਬਣਿਆ ਰਿਹਾ ਹੈ ਇਤਿਹਾਸਿਕ ਬ੍ਰਿਤਾਂਤ ਸਮਕਾਲੀ ਸੱਭਿਆਚਾਰ ਅਭਿਆਸਾਂ ਨੂੰ ਬਹੁਤ ਜ਼ਿਆਦਾ ਪ੍ਰਭਾਵ ਕ ਪ੍ਰਭਾਵਿਤ ਕਰਦੇ ਹਨ ਸੱਭਿਆਚਾਰ ਪੰਜਾਬ ਦੇ ਲੋਕਾਂ ਦਾ ਦੂਸਰੇ ਲੋਕਾਂ ਤੋਂ ਬਹੁਤ ਵੱਖਰਾ ਅਤੇ ਨਵੇਕਲਾ ਹੈ ਅਤੇ ਲੋਕਾਂ ਦੀ ਇੱਕ ਵੱਖਰੀ ਪਹਿਚਾਣ ਬਣਾਉਂਦਾ ਹੈ ਪੰਜਾਬ ਦੇ ਲੋਕ ਨਿਵੇਕਲੀ ਸ਼ਖਸ਼ੀਅਤ ਵਾਲੇ ਹੁੰਦੇ ਹਨ ਇਹ ਪੰਜਾਬ ਦੇ ਇਤਿਹਾਸ ਤੋਂ ਹੀ ਪਤਾ ਲੱਗਦਾ ਹੈ ਪੰਜਾਬ ਦਾ ਇਤਿਹਾਸ ਬਹੁਤ ਨਿਵੇਕਲਾ ਹੈ ਅਤੇ ਲੋਕਾਂ ਨੂੰ ਇੱਕ ਵੱਖਰੀ ਪਹਿਚਾਣ ਦਿੰਦਾ ਹੈ ਜਿਸ ਦੇ ਨਾਲ ਭਾਰਤ ਦੇ ਲੋਕ ਕਿਸੇ ਵੀ ਸਥਾਨ 'ਤੇ ਚਲੇ ਜਾਣ ਉਹਨਾਂ ਦਾ ਇਤਿਹਾਸ ਲੋਕਾਂ ਦੀ ਪਹਿਚਾਣ ਕਰਵਾ ਦਿੰਦਾ ਹੈ